ਮੈਨੂੰ ਪਸੰਦ ਤਾਂ ਸਾਰੇ ਹੀ ਪ ਵਧੀਆ ਲੱਗਦੇ ਮੈਨੂੰ ਪਸੰਦ ਸਾਰੇ ਪੌਦੇ ਹੀ ਵਧੀਆ ਲੱਗਦੇ ਹਨ ਪਰ ਕੁਝ ਪੌਦੇ ਇਹੋ ਜਿਹੇ ਹਨ ਜੋ ਮੈਨੂੰ ਬਹੁਤ ਹੀ ਪਸੰਦ ਹਨ ਅਤੇ ਉਹਨਾਂ ਦੇ ਲਾਭ ਵੀ ਬਹੁਤ ਹੀ ਵਧੀਆ ਹਨ ਮੈਨੂੰ ਬੋ ਪੌਦ ਮੈਨੂੰ ਨਿੰਬੂ ਦਾ ਪੌਦਾ ਬਹੁਤ ਹੀ ਵਧੀਆ ਲੱਗਦਾ ਹੈ ਇਸ ਦੇ ਜਿਹੜੇ ਲਾਭ ਹਨ ਇਸ ਨਾਲ ਸਾਨੂੰ ਗਰਮੀਆਂ ਵਿੱਚ ਨਿੰਬੂ ਪਾਣੀ ਬਣਾ ਕੇ ਪੀਣ ਨਾਲ ਸਾਨੂੰ ਕਦੇ ਵੀ ਘਬਰਾਹਟ ਨਹੀਂ ਹੁੰਦੀ ਅਤੇ ਇਹ ਹਰੇਕ ਚੀਜ਼ 'ਚ ਕੰਮ ਵੀ ਆਉਂਦਾ ਹੈ ਜਿਸ ਇਹ ਸਾਡੇ ਲਈ ਬਹੁਤ ਹੀ ਲਾਭਦਾਇਕ ਹੈ ਮੈਨੂੰ ਅਨਾਰ ਦਾ ਪੌਦਾ ਵੀ ਬਹੁਤ ਹੀ ਪਸੰਦ ਹੈ ਅ ਅਨਾਰ ਸਾਡੀ ਸਿਹਤ ਲਈ ਬਹੁਤ ਹੀ ਵਧੀਆ ਇਸ ਨਾਲ ਸਾਡੇ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਇਸ ਲਈ ਇਹ ਵੀ ਸਾਡੇ ਲਈ ਬਹੁਤ ਹੀ ਵਧੀਆ ਹੈ ਅਤੇ ਸਾਨੂੰ ਨਾਰੀਅਲ ਦਾ ਪੌਦ ਮੈਨੂੰ ਨਾਰੀਅਲ ਦਾ ਪੌਦਾ ਵੀ ਬਹੁਤ ਹੀ ਵਧੀਆ ਲੱਗਦਾ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਵਧੀਆ ਹੈ ਇਸ ਨਾਲ ਸਾਡੇ ਸਰੀਰ ਨੂੰ ਕਦੇ ਵੀ ਸਾਡੇ ਸਰੀਰ ਵਿੱਚ ਸੈਲ ਦੀ ਕਮੀ ਨਹੀਂ ਹੁੰਦੀ ਇਹ ਸਾਡੇ ਸਰੀਰ ਲਈ ਬਹੁਤ ਹੀ ਵਧੀਆ ਹੈ ਅਤੇ ਮੈਨੂੰ ਕੇਲੇ ਦਾ ਪੇੜ ਵੀ ਬਹੁਤ ਹੀ ਪਸੰਦ ਹੈ ਜੋ ਸਾ ਜਿਸ ਨਾਲ ਸਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਲੱਗਦੀ ਇਹ ਵੀ ਸਾਡੇ ਲਈ ਬਹੁਤ ਹੀ ਵਧੀਆ ਇ ਇਸ ਕੇਲੇ ਨੂੰ ਅਸੀਂ ਮੈਂਸ਼ ਕਰਕੇ ਇਸ ਦਾ ਜੂਸ ਵੀ ਬਣਾ ਕੇ ਪੀ ਸਕਦੇ ਹਾਂ ਇਹ ਵੀ ਬਹੁਤ ਹੀ ਵਧੀਆ ਰੋਜ਼ਾਨਾ ਸਾਨੂੰ ਪੀਣਾ ਚਾਹੀਦਾ ਹੈ ਇਹ ਮੈਨ ਮੇਰੇ ਬਹੁਤ ਹੀ ਮਨਪਸੰਦ ਪੌਦੇ ਹਨ